ਸਰ ਅਸੀਂ ਦੇਖੋ ਆਪਣੇ ਬਾਗ ਵਿੱਚ ਆਪਾਂ ਨੂੰ ਪੌਦੇ ਸ਼ਾਮਿਲ ਕਰਨੇ ਚਾਹੀਦੇ ਵੀ ਹੈ ਔਰ ਜ਼ਰੂਰੀ ਵੀ ਹੈ ਠੀਕ ਹੈ ਪਹਿਲਾਂ ਤਾਂ ਕਹਿੰਦੇ ਹੈ ਕਿ ਆਪਾਂ ਕਰਦੇ ਹੋ ਕਰਦੇ ਹਾਂ ਬਿਲਕੁਲ ਕਰਦੇ ਹਾਂ ਅਤੇ ਮਹੱਤਵਪੂਰਨ ਕਿਉਂ ਹੈ ਕਿਉਂਕਿ ਇਹ ਚੀਜ਼ਾਂ ਆਪਾਂ ਜਿਹੜੀ ਆਪਾਂ ਬਾਜ਼ਾਰੋਂ ਖਰੀਦਣੀ ਹੈ ਆਪਾਂ ਆਪਣੇ ਘਰ ਵੀ ਉਗਾ ਸਕਦੇ ਹੈ ਫੋਰ ਐਗਜਾਮਪਲ ਕਿਉਂਕਿ ਅਗਰ ਮੈਂ ਇੱਕ ਉਦਾਹਰਣ ਦੇ ਤੌਰ 'ਤੇ ਲਵਾਂ ਮੈਂ ਆਪਣੇ ਘਰ ਵਿੱਚ ਭਿੰਡੀਆਂ ਬੀਜੀਆਂ ਹੋਈਆਂ ਕਰੇਲੇ ਬੀਜੇ ਹੋਏ ਹੈ ਅੱਲਾਂ ਬੀਜੀਆਂ ਹੋਈਆਂ ਠੀਕ ਹੈ ਹੋਰ ਵੀ ਕਈ ਤਰ੍ਹਾਂ ਦੇ ਬੈਂਗਣਾਂ ਦੇ ਬੂਟੇ ਹੈ ਪੁਦੀਨਾ ਆ ਮਿਰਚਾਂ ਆ ਬਹੁਤ ਕੁਛ ਹੈ ਬਹੁਤ ਕੁਛ ਮੈਂ ਆਪਣੇ ਘਰ ਖੁਦ ਹੀ ਬੀਜਿਆ ਹੋਇਆ ਔਰ ਮੈਨੂੰ ਵਧੀਆ ਵੀ ਲੱਗਦਾ ਇਹਨਾਂ ਨੂੰ ਬੀਜਣਾ ਇਹਨਾਂ ਨੂੰ ਪਾਣੀ ਦੇਣਾ ਟਾਈਮ ਟੂ ਟਾਈਮ ਔਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਸਾਡੀ ਲਾਈਫ ਦੇ ਵਿੱਚ ਇੱਕ ਤਾਂ ਇਨਵਾਇਰਮੈਂਟ ਵਧੀਆ ਰਹਿੰਦਾ ਉਹ ਤਾਂ ਆਪਾਂ ਵਧੀਆ ਖਾਂਦੇ ਹਾਂ ਕਿ ਪਿਓਰ ਖਾਂਦੇ ਹਾਂ ਜਿਹੜੇ ਬਾਜ਼ਾਰ ਦੀਆਂ ਸਬਜ਼ੀਆਂ ਉਹਦੇ ਵਿੱਚ ਕਿੰਨਾ ਕੁਛ ਕੈਮੀਕਲਸ ਵਗੈਰਾ ਆਪਾਂ ਰੋਜ਼ ਸੁਣਦੇ ਹਾਂ ਕਿ ਅੱਜ ਇਹਦੇ 'ਚ ਇੰਨਾਂ ਕੈਮੀਕਲ ਮਿਲਿਆ ਅੱਜ ਇਹਦੇ 'ਚ ਕਿੰਨਾ ਕੈਮੀਕਲ ਮਿਲਿਆ ਆਪਾਂ ਗੱਲ ਕਰੀਏ ਕਿਸ ਟਾਈਮ ਅੰਬਾਂ ਦਾ ਸੀਜ਼ਨ ਹੈ ਅੰਬਾਂ ਨੂੰ ਕਿੰਨੇ ਕਿੰਨੇ ਕੈਮੀਕਲ ਲੱਗਦੇ ਹੈ ਮੂੰਹ 'ਚ ਪਾਈਏ ਅੰਬ ਤਾਂ ਮੂੰਹ ਪੱਕ ਜਾਂਦਾ ਕਿੰਨਾ ਕੁਛ ਕਿੰਨਾ ਹੋ ਰਿਹਾ ਉਹੀ ਜੇ ਇਹੀ ਅੰਬ ਜੇ ਆਪਣੇ ਘਰ ਬੀਜਿਆ ਹੋਏਗਾ ਅਤੇ ਸਾਰਾ ਕੁਛ ਵਧੀਆ ਅੰਬਾਂ ਥੋੜ੍ਹੀ ਦੇਰ ਔਖਾ ਹੈ ਉਸ ਤੋਂ ਬਾਅਦ ਤਾਂ ਆਪਾਂ ਹਰ ਸੀਜ਼ਨ ਸਾਨੂੰ ਅੰਬ ਫਰੀ 'ਚ ਘਰ ਦੇ ਮਿਲਣੇ ਹੈ ਉਸ ਤਰ੍ਹਾਂ ਅਮਰੂਦ ਘਰ ਹੋਵੇ ਹੁਣ ਗੱਲ ਆ ਜਾਂਦੀ ਹੈ ਮੇਨ ਕਿ ਜਗ੍ਹਾ ਦੀ ਕਿ ਘਰਾਂ ਵਿੱਚ ਜਗ੍ਹਾ ਨਹੀਂ ਹੈਗੀ ਅੱਜ ਕੱਲ੍ਹ ਪਰ ਜਿਹੜੇ ਆਪਾਂ ਵੀ ਤਾਂ ਆਪਣੇ ਘਰੇ ਕੋਠੇ ਤੋਂ ਉੱਪਰ ਸਾਰਾ ਕੁਛ ਬੀਜਿਆ ਹੋਇਆ ਅਤੇ ਕੋਠੇ 'ਤੇ ਆਪਾਂ ਥੋੜ੍ਹੀ ਜਿਹੀ ਮਿਹਨਤ ਕਰਨ ਦੀ ਗੱਲ ਹੈ ਕੋਠੇ ਦੇ ਉੱਪਰ ਗਮਲੇ ਰੱਖੋ ਜਿੱਦਾਂ ਕੋਈ ਟੰਕੀ ਹੁੰਦੀ ਹੈ ਉਹਦੇ ਵਿੱਚ ਅਮਰੂਦ ਦਾ ਬੂਟਾ ਹੋ ਜਾਂਦਾ ਅੰਬ ਹੋ ਜਾਂਦਾ ਸਭ ਕੁਛ ਲੱਗਿਆ ਹੋਇਆ ਜਿੱਦਾਂ ਥੋੜ੍ਹੇ ਜਿਹੇ ਗਲੀ 'ਚੋਂ ਥੋੜ੍ਹੀ ਜਿਹੀ ਜਗ੍ਹਾ ਅਗਰ ਤੁਹਾਨੂੰ ਕੱਚੀ ਮਿਲਦੀ ਹੈ ਉਹਦੇ ਵਿੱਚ ਵੀ ਅੰਬ ਹੋ ਜਾਂਦਾ ਇਸ ਕਰਕੇ ਜਿਹੜਾ ਆ ਦੇਸੀ ਪੌਦਿਆਂ ਨੂੰ ਘਰ ਵਿੱਚ ਜ਼ਰੂਰ ਸ਼ਾਮਲ ਕਰੋ ਔਰ ਪੌਦੇ ਜਿਹੜੇ ਹੈ ਆਪਣੇ ਸਬਜ਼ੀਆਂ ਬੀਜੋ ਸਭ ਕੁਛ ਬੀਜੋ ਘਰੇ ਘਰ ਦੀਆਂ ਸਬਜ਼ੀਆਂ ਖਾਓ